ਕੋਵਿਡ ਜੋ ਕਿ ਦੋ ਹਜ਼ਾਰ ਇੱਕੀ ਨੂੰ ਆਇਆ ਸੀ ਅਤੇ ਮੋਬਾਇਲ ਫੋਨ ਦੇ ਬੱਚਿਆਂ ਨੇ ਪੜ੍ਹਾਈ ਦੀ ਕਾਫੀ ਮਦਦ ਕੀਤੀ ਹੈ ਪਰ ਦੂਜੇ ਪਾਸੇ ਅਗਰ ਦੇਖਿਆ ਜਾਵੇ ਤਾਂ ਲੋਕਡਾਊਨ ਦੇ ਕਰਕੇ ਬੱਚਿਆਂ ਦੀ ਪੜ੍ਹਾਈ ਬਹੁਤ 'ਤੇ ਬਹੁਤ ਨੁਕਸਾਨ ਵੀ ਹੋਇਆ ਹੈ ਜਿੱਥੇ ਬੱਚਿਆਂ ਨੂੰ ਮੋਬਾਇਲ ਫੋਨ ਨਹੀਂ ਸੀ ਮਿਲਦੇ ਪਰ ਲੋਕਡਾਊਨ ਦੇ ਵਿੱਚ ਔਨਲਾਈਨ ਕਲਾਸਾਂ ਦੇ ਕਰਕੇ ਉਹਨਾਂ ਨੂੰ ਮੋਬਾਈਲ ਫੋਨ ਦਿੱਤੇ ਗਏ ਜਿਸ ਕਰਕੇ ਬੱਚਿਆਂ ਦਾ ਭਵਿੱਖ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਅਤੇ ਇਹ ਪੇਰੈਂਟਸ 'ਤੇ ਉਹਨਾਂ ਦੇ ਘਰਦਿਆਂ 'ਤੇ ਬਹੁਤ ਜ਼ਿਆਦਾ ਬੋਝ ਆ ਚੁੱਕਾ ਹੈ ਉਹਨਾਂ 'ਤੇ ਪੜ੍ਹਾਈ ਦੇ ਵਿੱਚ ਕਾਫੀ ਮਦਦ ਕੀਤੀ ਹੈ ਮੋਬਾਇਲ ਫੋਨ ਨੇ ਸਕੂਲ ਦੀ ਸਾਰੀ ਪੜ੍ਹਾਈ ਉਹਨਾਂ ਦੀ ਫੋਨਾਂ 'ਤੇ ਹੁੰਦੀ ਸੀ ਅਤੇ ਉਹਨਾਂ ਨੂੰ ਬਹੁਤ ਕੁਛ ਵਧੀਆ ਸਿੱਖਣ ਨੂੰ ਮਿਲਦਾ ਸੀ ਅਤੇ ਉਹਨਾਂ ਦੀ ਕਮਿਊਨੀਕੇਸ਼ਨ ਸਕਿੱਲਸ ਵੀ ਬਹੁਤ ਜ਼ਿਆਦਾ ਵਧੀਆ ਹੋਈਆਂ ਇਹਦੇ ਨਾਲ ਅਤੇ ਉਹ ਬੋ ਜ਼ਿਆਦਾ ਤੋਂ ਜ਼ਿਆਦਾ ਬੋਲਣ 'ਚ ਵੀ ਉਹਨਾਂ ਲਈ ਮਦਦ ਹੋਈ ਹੈ ਅਤੇ ਅਗਰ ਨੁਕਸਾਨ ਦੀ ਗੱਲ ਕਰੀਏ ਨੁਕਸਾਨ ਕੁਝ ਜ਼ਿਆਦਾ ਹੋਏ ਹਨ ਫਾਇਦੇ ਨਾਲੋਂ ਨੁਕਸਾਨ ਬੱਚਿਆਂ ਦੇ ਅੱਜ ਕੱਲ੍ਹ ਕੋਈ ਵੀ ਛੋਟੇ ਛੋਟੇ ਬੱਚੇ ਵੀ ਫੋਨ ਚਲਾਉਂਦੇ ਹਨ ਜੋ ਕਿ ਬਹੁਤ ਗਲਤ ਹੈ ਜੋ ਕਿ ਆਪਣੇ ਆਉਣ ਵਾਲੇ ਭਵਿੱਖ ਨੂੰ ਖ਼ਰਾਬ ਕਰੇ ਕਰੇਗਾ ਅਤੇ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਫਿ ਪੰਜਵੀਂ ਤੋਂ ਛੇਵੀਂ ਅਗਰ ਦੇਖਿਆ ਜਾਵੇ ਤਾਂ ਉਹ ਵੀ ਬੱਚੇ ਆ ਅੱਜ ਕੱਲ੍ਹ ਫੋਨ ਫੋਨਾਂ 'ਤੇ ਚਲਾਉਂਦੇ ਰਹਿੰਦੇ ਆ ਉਹਨੂੰ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਸ ਸਮ ਪਰਿਵਾਰ ਵਾਲਿਆਂ ਨੂੰ ਸਮਾਂ ਨਹੀਂ ਦਿੰਦੇ